ਹੈਲੋ ਹਾਂਜੀ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਉੱਥੋ ਹੀ ਬੋਲਦੇ ਜੀ ਹਾਂਜੀ ਮਿਲ ਜਾਵੇਗੀ ਜੀ ਕਿਹੜੀ ਲੈਣੀ ਹੈ ਜੀ ਸਾਡੇ ਕੋਲ ਦਿੱਲੀ ਨੰਬਰ ਹੈਗੀ ਹੈ ਜੀ ਸਵਿਫਟ ਹੈਗੀ ਹੈ ਫਿਗੋ ਹੈਗੀ ਹੈ ਸਕੋਡਾ ਹੈਗੀ ਹੈ ਜੀ ਓਡੀ ਹੈਗੀ ਹੈ ਬੀ ਐਮ ਡਬਲਯੂ ਹੈਗੀ ਹੈ ਮਤਲਬ ਸਾਰੀਆਂ ਹੀ ਪਈਆਂ ਜੀ ਸਕਾਰਪੀਓ ਵੀ ਹੈਗੀ ਹੈ ਸਕਾਰਪੀਓ ਤੁਸੀਂ ਲਾ ਲਉ ਦੋ ਹਜ਼ਾਰ ਉੱਨੀ ਮੋਡਲ ਹੈ ਜੀ ਡਿਮਾਂਡ ਤਾਂ ਛੇ ਦੀ ਹੈ ਤੁਸੀਂ ਚਾਹੇ ਪੰਜ ਤੱਕ ਮੈਂ ਮਨਾ ਲਵਾਂਗਾ ਤੁਸੀਂ ਮਨ ਬਣਾ ਲਉ ਆ ਜਾਓ ਦੇਖ ਜੋ ਕੰਡੀਸ਼ਨ ਬਿਲਕੁਲ ਸਾਫ਼ ਹੈ ਜੀ ਤੁਸੀਂ ਸਾਰੀ ਹਾਂਜੀ ਹਾਂਜੀ ਬੰਦੇ ਨੇ ਪੂਰੀ ਪੂਰੀ ਵਧੀਆ ਬਣਾਈ ਹੋਈ ਹੈ ਟਾਇਰ 'ਤੇ ਐਲੋਏ ਪਾਏ ਹੋਏ ਹੈ ਇੰਨਟੀਰੀਅਰ ਪੂਰਾ ਬਣਾਇਆ ਹੋਇਆ ਮੈਟੀ ਗਲਾਸ 'ਤੇ ਇੰਨਟੀਰੀਅਰ ਲੱਗਿਆ ਹੋਇਆ ਜੀ ਕ ਸਿਸਟਮ ਲੱਗਿਆ ਹੋਇਆ ਪੂਰਾ ਐਨਡਰੋਇਡ ਸਿਸਟਮ ਲੱਗਿਆ ਹੋਇਆ ਸਾਰੀ ਲਾਇਟਾਂ ਚੱਲਦੀਆਂ ਪਈਆ ਏ ਸੀ ਚੱਲਦਾ ਪਿਆ ਏਥ ਸਕੋਡਾ ਤੁਹਾਨੂੰ ਲੱਗਜੂਗੀ ਦੋ ਹਜ਼ਾਰ ਅਠਾਰਾਂ ਮੋਡਲ ਹੈ ਸਕੋਡਾ ਔਕਟੇਵੀਆ ਹੀ ਹੈ ਉਹ ਤਿੰਨ ਲੱਖ 'ਚ ਲੱਗ ਜਾਵੇਗੀ ਜੀ ਹਾਂਜੀ ਹਾਂ ਕੰਡੀਸ਼ਨ ਦੋਨਾਂ ਦੀ ਵਧੀਆ ਹੈ ਸਾਫ਼ ਹੈ ਬਸ ਪੇਪਰ ਵਰਕ ਸਕੋਰਪੀਓ ਦੇ ਸਾਰੇ ਹੈ ਜੀ ਇੰਨਸ਼ੋਐਰਸ ਵੀ ਹੈਗੀ ਹੈ ਜੀ ਥਰਡ ਪਾਰਟੀ ਇੰਨਸ਼ੋਅਰੈਸ ਹੈ ਜਿਹੜੀ ਸਕੋਡਾ ਹੈ ਸਕੋਡਾ ਸਕੋਡਾ ਦੀ ਇੰਨਸ਼ੋਅਰੈਸ ਨਹੀਂ ਹੈ ਹਾਂ ਜਿੱਦਾਂ ਤੁਹਾਨੂੰ ਠੀਕ ਲੱਗਦਾ ਆਪਾਂ ਉੱਦਾਂ ਕਰ ਲਵਾਂਗੇ ਜੇ ਤੁਸੀਂ ਲੋਨ 'ਤੇ ਕਰਵਾਉਣਾ ਅਸੀਂ ਲੋਨ ਵੀ ਲੋਨ ਦੀ ਸੁਵਿਧਾ ਵੀ ਹੈਗੀ ਹੈ ਅਸੀਂ ਉਪਲਬਧ ਕਰਾ ਦਿੰਦੇ ਹਾਂ ਹਾਂਜੀ ਹਾਂ ਬਾਕੀ ਕੋਈ ਹੋਰ ਜੇ ਹੋਰ ਵੀ ਤੁਸੀਂ ਗੁੜਗਾਓ ਦੀ ਵੀ ਗੱਡੀਆਂ ਹੈਗੀਆਂ ਜੋ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਇੱਕ ਵਾਰੀ ਆ ਜਾਉ ਦੇਖ ਜੋ ਤੁਹਾਨੂੰ ਵਧੀਆ ਲੱਗੇਗਾ ਹੋਰ ਵੀ ਮਾਣ ਤਾਣ ਕਰ ਦੇਵਾਂਗੇ ਅਸੀਂ ਠੀਕ ਹੈ ਜੀ ਮੈਂ ਤੁਹਾਨੂੰ ਇਸੇ ਨੰਬਰ 'ਤੇ ਕਰਦਾ ਨਾ ਠੀਕ ਹੈ ਠੀਕ ਹੈ ਜੀ ਹਾਂਜੀ ਹਾਂ ਹੈਗੇ ਹੈਗੇ ਸਭ ਮਿਲਜੂਗੀ ਹੋਰ ਵਧੀਆ ਵੀ ਮਿਲ ਜਾਣਗੀਆਂ ਤੁਸੀਂ ਆਜੋ ਇੱਕ ਵਾਰੀ ਕੀ ਠੀਕ ਹੈ ਜੀ ਮੈਂ ਹੁਣੇ ਕਰਦਾ ਹਾਂ ਓਕੇ ਜੀ ਸਤਿ ਸ਼੍ਰੀ ਅਕਾਲ